ਚੋਕਲੇਟ ਡੈਰੀ ਮਿਲਕ ਫਾਈਵ ਸਟਾਰ ਸਿਲਕ ਨੈ ਨਟਸ ਵਾਲੇ ਚੋਕਲੇਟ ਡਾਰਕ ਚੋਕਲੇਟ ਪੇਸਟੀ ਵਨੀਲਾ ਪੇਸਟੀ ਐਪ ਮੈਂਗੋ ਪੇਸਟੀ ਐਪਲ ਪੇਸਟੀ